ਹੈਲੋ ਸਤਿ ਸ਼੍ਰੀ ਅਕਾਲ ਜੀ ਸਟੇਸ਼ਨ ਤੋਂ ਬੋਲਦੇ ਹੋ ਰੇਲਵੇ ਸਟੇਸ਼ਨ ਤੋਂ ਹਾਂਜੀ ਸਰ ਮੈਂ ਨਾ ਤੁਹਾਨੂੰ ਇਹ ਪੁੱਛਣਾ ਸੀ ਕੀ ਕਹਿੰਦੇ ਆ ਅੰਮ੍ਰਿਤਸਰ ਦੀ ਟ੍ਰੇਨ ਕਦੋਂ ਜਾਂਦੀ ਮੋਹਾਲੀ ਤੋਂ ਅਸੀਂ ਟ੍ਰੇਨ ਲੈਣੀ ਸੀ ਅੱਛਾ ਜੀ ਅੱਛਾ ਜੀ ਸਰ ਉਹ ਏ ਸੀ ਵਾਲੀ ਹੋਵੇਗੀ ਕਿ ਬਿਨ੍ਹਾਂ ਏ ਸੀ ਵਾਲੀ ਅੱਛਾ ਜੀ ਅੱਛਾ ਜੀ ਉਹਦਾ ਅੱਛਾ ਜੀ ਅੱਛਾ ਜੀ ਅੱ ਅੱਛਾ ਜੀ ਅਸੀਂ ਸ਼ਾਮ ਦਾ ਕਿੰਨਾ ਟਾਈਮ ਹੈ ਜੀ ਜੇ ਸ਼ਾਮ ਨੂੰ ਜਾਣਾ ਹੋਵੇ ਜੇ ਸ਼ਾਮ ਨੂੰ ਜਾਣਾ ਜੀ ਹਾਂਜੀ ਜੀ ਅੱਛਾ ਜੀ ਅਤੇ ਖਾਣਾ ਪੀਣਾ ਵਿੱਚ ਹੀ ਹੁੰਦਾ ਏ ਏ ਸੀ ਵਾਲੀ ਹੈ ਕਿ ਬਿਨ੍ਹਾਂ ਏ ਸੀ ਵਾਲੀ ਅੱਛਾ ਜੀ ਅਤੇ ਏ ਸੀ ਵਾਲੀ ਆ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅਤੇ ਸਫ਼ਾਈ ਹੈਗੀ ਹੈ ਜੀ ਅੱਛਾ ਜੀ ਅੱਛਾ ਜੀ ਚਲੋ ਜੀ ਚਲ ਚਲੋ ਜੀ ਧੰਨਵਾਦ ਸਰ ਅੱਛਾ ਜੀ ਠੀਕ ਹੈ ਠੀ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਤੁਹਾਡਾ ਧੰਨਵਾਦ ਜੀ